ਮੇਰੇ ਖੇਤਰ ਵਿੱਚ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ਵਿੱਚ ਗੁਰਦੁਆਰਾ ਪਤਾਲੀਪੁਰੀ ਸਾਹਿਬ ਜਿੱਥੇ ਲੋਕ ਕਈ ਰਸਮਾਂ ਨਿਭਾਉਂਦੇ ਹਨ ਜਦੋਂ ਕਿਸੇ ਪਰਿਵਾਰ ਵਿੱਚ ਕਿਸੇ ਦੀ ਮਰਗਤ ਹੋ ਜਾਂਦੀ ਹੈ ਤਾਂ ਉੱਥੇ ਇਸ ਪੁਤਾਲਪੁਰੀ ਦੇ ਵਿੱਚ ਫੁੱਲ ਵਹਾਏ ਜਾਂਦੇ ਹਨ ਅਤੇ ਲੋਕ ਨਤਮਸਤਕ ਹੁੰਦੇ ਹਨ ਇਸ ਤੋਂ ਇਲਾਵਾ ਕੇਸਗੜ੍ਹ ਸਾਹਿਬ ਵਿੱਚ ਲੋਕ ਹੋਲਾ ਮਹੱਲੇ ਦਾ ਤਿਉਹਾਰ ਬੜੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਇੱਥੇ ਰੰਗ ਲਾ ਕੇ ਮ ਅ ਰਸਮਾਂ ਨਿਭਾਈਆਂ ਜਾਂਦੀਆਂ ਹਨ